ਹਾਂ ਮੇਰਾ ਮਨਪਸੰਦ ਅਖ਼ਬਾਰ ਅਜੀਤ ਹੈ ਅਤੇ ਇਸ ਤੋਂ ਇਲਾਵਾ ਮੈਂ ਪੰਜਾਬ ਕੇਸਰੀ ਨੂੰ ਵੀ ਪੜ੍ਹਿਆ ਹੈ ਇਸ ਵਿੱਚ ਦੋਨੇ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਅਤੇ ਦੋਨੋਂ ਵੱਖਰੇ ਵੱਖਰੇ ਹਨ ਅਤੇ ਅਜੀਤ ਵਿੱਚ ਬਹੁਤ ਜ਼ਿਆਦਾ ਵਿਸਥਾਰਪੂਰਵਕ ਅਖਬਾ ਖ਼ਬਰ ਦਿੱਤੀ ਹੁੰਦੀ ਹੈ ਅਤੇ ਪੰਜਾਬ ਕੇਸਰੀ ਵਿੱਚ ਸਿਰਫ਼ ਹੈੱਡਲਾਈਨ 'ਤੇ ਹੀ ਫੋਕਸ ਕੀਤਾ ਜਾਂਦਾ ਹੈ